ਪੰਜਾਬ ਵੈਸੇ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਇੱਥੇ ਵਹਿਮ ਭਰਮ ਦਾ ਜ਼ਿਆਦਾਤਰ ਸਥਾਨ ਹੈ ਨਹੀਂ ਪਰ ਜਿਹੜੇ ਕਰਦੇ ਕਰਦੇ ਹੀ ਆ ਸਵੇਰੇ ਪਾਣੀ ਛਿੜਕਣਾ ਛਿੜਕੀ ਜਾਣਾ ਖਵਾਜਾ ਨੂੰ ਖਰਾਬ ਕਰਨਾ ਉਹਦਾ ਪਾਣੀ ਸਿੱਟ ਸਿੱਟ ਕੇ ਸਵੇਰੇ ਬੂਟਿਆਂ ਦੇ ਨਾਂ 'ਤੇ ਗੱਡੀ ਦੇ ਨਾਂ 'ਤੇ ਪਾਣੀ ਦੀ ਬਰਬਾਦੀ ਕਰਨਾ ਅਤੇ ਚੁਰਾਹੇ ਵਿੱਚ ਦਿਵਾਲੀ ਵਾਲੇ ਦਿਨ ਟੂਣੇ ਟੱਪੇ ਕਰਨਾ ਜਾਂ ਅੱਜ ਵੀ ਪਿੱਪਲ ਥੱਲੇ ਦੀਵਾ ਜਗਾਉਣਾ ਸ਼ਨੀ ਦੇਵ ਦਾ ਜਾਂ ਸ਼ਨੀਦੇਵ ਨੂੰ ਪ ਪ੍ਰਭਾਵ ਤੋਂ ਡਰਨਾ ਰਾਹੂ ਦੇ ਪ੍ਰਭਾਵ ਤੋਂ ਡਰਨਾ ਇਹ ਲੋਕ ਜਿਹੜੇ ਆ ਵਿਸ਼ਵਾਸ਼ ਜਿਹੜੇ ਆ ਇਹ ਲੋਕਾਂ ਦੇ ਵਿੱਚ ਘਰ ਕਰ ਚੁੱਕੇ ਆ ਪੜ੍ਹੇ ਲਿਖੇ ਇਨਸਾਨ ਵੀ ਪੰਜਾਬ ਦੇ ਵਿੱਚ ਟੂਣੇ ਟੱਪੇ ਕਰਦੇ ਆ ਜਾਂ ਰਿਟਾਇਰਮੈਂਟ ਤੋਂ ਬਾਅਦ ਉਹ ਆਪਣੇ ਨਿਆਣਿਆਂ ਦੇ ਵਿਆਹ ਵਾਸਤੇ ਆਪਣੇ ਕੋਸ਼ਿਸ਼ ਕਰਦੇ ਲ ਲੱਗੇ ਰਹਿੰਦੇ ਹਨ ਕ ਕੀੜੀਆਂ ਦੇ ਭੌਣ 'ਤੇ ਆਟਾ ਪਾਉਣ ਚਲੇ ਗਏ ਜਾਂ ਫਿਰ ਦਰਿਆ 'ਤੇ ਨਹਿਰਾਂ 'ਤੇ ਟੂਣਾ ਟੱਪਾ ਕਰਕੇ ਸਮਾਨ ਛੱਡਣ ਚਲੇ ਗਏ ਅਤੇ ਆਮ ਜਿਹੀ ਗੱਲ ਹੈ ਪੰਜਾਬ ਦੇ ਵਿੱਚ ਕਿ ਇਸ 'ਤੇ ਅਸੀਂ ਵਿਸ਼ਵਾਸ਼ ਪੜ੍ਹੇ ਲਿਖੇ ਤਾਂ ਨਹੀਂ ਕਰਦੇ ਪਰ ਫਿਰ ਵੀ ਵਿਸ਼ਵਾਸ ਫਸ ਜਾਂਦੇ ਹਨ ਇਹਨਾਂ ਤੋਂ ਵਿਸ਼ਵਾਸ ਕ ਨਹੀਂ ਕਰਨਾ ਚਾਹੀਦਾ ਕਿਉਂਕਿ ਇਹਦੇ ਵਿੱਚ ਪੈਸੇ ਦੀ ਬਰਬਾਦੀ ਸਮੇਂ ਦੀ ਬਰਬਾਦੀ ਹੈ ਉਹ ਟਾਈਮ ਜਿਹੜਾ ਇਹ 'ਤੇ ਲਾਣਾ ਆ ਉਹ ਤੁਸੀਂ ਆਪਣੇ ਕਿਸੇ ਕੰਮ 'ਤੇ ਲਾਓ ਜਿਹੜੇ ਪੈਸੇ ਉਹ 'ਤੇ ਲਾਣੇ ਕਿਸੇ ਆਪਣੇ ਕੰਮ ਨੂੰ ਵਧਾਓ ਇਹ ਸਾਡੇ ਲਈ ਜ਼ਰੂਰੀ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਲੋਕ ਵਹਿਮਾਂ ਭਰਮਾਂ ਵਿੱਚ ਫਸੇ ਆ ਪਰ ਜ਼ਿਆਦਾਤਰ ਲੋਕ ਜਿਹੜੇ ਆ ਸੌ ਵਿੱਚੋਂ ਤੀਹ ਪ੍ਰਸੈਂਟ ਟੂਣਾ ਟੱਪੇ ਕਰਨ ਦੇ ਵਿੱਚ ਯਕੀਨ ਰੱਖਦੇ ਹਨ ਕਿ ਮੇਰਾ ਕੰਮ ਇਸੇ ਹਿਸਾਬ ਨਾਲ ਹੋ ਜਾਵੇ ਜੇ ਮੰਦਰਾਂ ਵਾਲਿਆਂ ਨੇ ਜਾਂ ਦੂਜੇ ਚੀਜ਼ਾਂ ਨੇ ਇਹਨਾਂ ਆਪਣੇ ਪੰਡਤਾਂ ਨੇ ਜਾਂ ਉਹਨਾਂ ਨੇ ਆਪਣੇ ਇਸ ਕੰਮ 'ਚ ਫਸਾ ਕੇ ਰੱਖਿਆ ਉਹ ਇਹ 'ਚੋਂ ਬਾਹਰ ਨਿਕਲਣਾ ਉਹਨਾਂ ਲਈ ਔਖਾ ਬਹੁਤ ਆ